ਮੈਂ ਜ਼ਿੰਦਗੀ ਵਿੱਚ ਜੋ ਸਬਕ ਸਿੱਖਿਆ ਮੈਂ ਤੁਹਾਨੂੰ ਦੱਸਣ ਜਾ ਰਿਹਾ ਜ਼ਿੰਦਗੀ ਵਿੱਚ ਪੜ੍ਹਾਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪੜ੍ਹਾਈ ਬਿਨਾ ਅੱਜ ਕੱਲ੍ਹ ਕੁਛ ਵੀ ਨਹੀਂ ਹੈ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਦੀ ਜਨਰੇਸ਼ਨ ਹੈ ਜੋ ਬਹੁਤ ਹੀ ਜ਼ਿਆਦਾ ਪੜ੍ਹਾਕੂ ਹੈ ਅਤੇ ਇਹ ਇਸਦੀ ਅਹਿਮੀਅਤ ਅੱਗੇ ਜਾ ਕੇ ਪਤਾ ਚੱਲਦੀ ਹੈ ਅਤੇ ਜੋ ਪਿਛਲੀ ਆਪਣੇ ਟਾਈਮ ਦੇ ਵਿੱਚ ਜੋ ਪੜ੍ਹੇ ਸੀਗੇ ਲਿਖੇ ਨੇ ਉਹਨਾਂ ਨੂੰ ਅੱਗੇ ਜ਼ਿਆਦਾ ਔਖਾ ਨਹੀਂ ਹੁੰਦਾ ਹੈਗਾ ਜੋ ਨਹੀਂ ਪੜ੍ਹਦੇ ਤਾਂ ਉਹਨਾਂ ਨੂੰ ਅੱਗੇ ਜਾ ਕੇ ਬਹੁਤ ਔਖਾ ਹੁੰਦਾ ਤਾਂ ਕਿ ਜੋ ਅੱਗੇ ਜਾ ਕੇ ਆਪਾਂ ਨੂੰ ਜੋ ਨੌਕਰੀ ਵਗੈਰਾ ਲੱਗਣ ਦੇ ਵਿੱਚ ਦਿੱਕਤ ਨਹੀਂ ਆਉਂਦੀ ਹੈਗੀ ਅਤੇ ਅੱਜ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਕੰਪੀਟੀਸ਼ਨ ਬਹੁਤ ਹੀ ਜ਼ਿਆਦਾ ਅਤੇ ਬਹੁਤ ਟੱਫ ਹੈ ਅੱਜ ਕੱਲ੍ਹ ਜੇ ਆਪਾਂ ਸਰਵਾਈਵ ਕਰਨਾ ਤਾਂ ਆਪਾਂ ਨੂੰ ਵਧੀਆ ਇੰਗਲਿਸ਼ ਵਧੀਆ ਆਪਣੀ ਕਨਵਰਸੇਸ਼ਨ ਹੋਣੀ ਚਾਹੀਦੀ ਆ ਜਿਸ ਨਾਲ ਅੱਗੇ ਸਾਨੂੰ ਕੋਈ ਦਿੱਕਤ ਨਾ ਹੋਵੇ ਜਿਸ ਕਰਕੇ ਆਪਾਂ ਅੱਗੇ ਕੋਈ ਵੀ ਜੋ ਮੈਦਾਨ ਹੈ ਜਿੱਥੇ ਵੀ ਆਪਾਂ ਜਾਣਾ ਉੱਥੇ ਆਪਾਂ ਸਫਲ ਹੋ ਜਾਈਏ ਅਤੇ ਮੈਂ ਇਹੀ ਸਬਕ ਸਿੱਖਿਆ ਹੈ ਕਿ ਅਗਰ ਆਪਾਂ ਪੜ੍ਹਾਂਗੇ ਨਹੀਂ ਤਾਂ ਅੱਗੇ ਬਹੁਤ ਮੁਸ਼ਕਲ ਹੋ ਜਾਣੀ ਹੈ ਅਤੇ ਅੱਜ ਕੱਲ੍ਹ ਦੀ ਪੀੜੀ ਬਹੁਤ ਹੀ ਜ਼ਿਆਦਾ ਪੜ੍ਹਦੀ ਹੈ ਅਤੇ ਜੋ ਅੱਜ ਕੱਲ੍ਹ ਨੌਜਵਾਨ ਹਨ ਉਹ ਇਸ ਗੱਲ ਨੂੰ ਸੀਰੀਅਸ ਨਹੀਂ ਲੈਂਦੇ ਹੈਗੇ ਅਤੇ ਮੈਂ ਇਹੀ ਚਾਹੁੰਦਾ ਹਾਂ ਵੀ ਸਬਕ ਹੈ ਜੋ ਮੇਰਾ ਵੀ ਆਪਣਾ ਪੜ੍ਹਾਈ ਸਭ ਤੋਂ ਪਹਿਲੀ ਉਸਨੂੰ ਇੰਪੋਰਟੈਂਟ ਦਿਉ ਤੁਸੀਂ ਪੜ੍ਹੋ ਲਿਖੋ ਦੈਨ ਅੱਗੇ ਤੁਹਾਡਾ ਫਿਊਚਰ ਹੈ ਜੋ ਵਧੀਆ ਹੋਵੇ ਅਤੇ ਜਿਸ ਵਿੱਚ ਤੁਹਾਨੂੰ ਫਿਊਚਰ ਬਣਾਉਣ ਵਿੱਚ ਜ਼ਿਆਦਾ ਦਿੱਕਤ ਨਾ ਆਵੇ ਅਤੇ ਇਹੀ ਇੱਕ ਸਬਕ ਜੋ ਮੈਂ ਸਿੱਖਿਆ